ਖੇਤੀ ਵਿੱਚ ਜਿਸ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ ਇਹਨਾਂ ਦੀ ਜਾਣਕਾਰੀ ਸਰੋਤ ਕੀਤੇ ਹਨ ਜਿਵੇਂ ਕਿ ਵਰਤੀਆਂ ਜਾਂਦੀਆਂ ਖੇਤੀ ਖੇਤ ਲਈ ਚੀਜ਼ਾਂ ਤਕਨੀਕਾਂ ਜਿਵੇਂ ਕਿ ਆਪਾਂ ਟਰੈਕਟਰ ਦੇ ਨਾਲ ਜੋ ਵੀ ਫ਼ਸਲ ਬੀਜਦੇ ਹਾਂ ਟਰੈਕਟਰ ਦੇ ਨਾਲ ਨਵੀਂ ਤਕਨੀਕ ਆਈ ਹੈ ਜਿਸ ਤਰ੍ਹਾਂ ਸਪਰੇ ਕਰਨੀ ਪਹਿਲਾਂ ਹੱਥ ਨਾਲ ਸਪਰੇ ਕਰਦੇ ਸੀ ਹੁਣ ਪੰਪਾਂ ਦੇ ਨਾਲ ਕਰਦੇ ਹਾਂ ਜਿਸ ਤਰ੍ਹਾਂ ਗੋਡੀ ਕਰਨੀ ਉਹ ਵੀ ਮਸ਼ੀਨਾਂ ਚੱਲ ਪਈਆਂ ਨੇ ਜਿਸ ਤਰ੍ਹਾਂ ਬੀਜ ਬੀਜਣੇ ਪਹਿਲਾਂ ਹੱਥਾਂ ਨਾਲ ਬੀਜ ਬੀਜਦੇ ਸੀ ਹੁਣ ਨਵੀਆਂ ਨਵੀਆਂ ਮਸ਼ੀਨਾਂ ਚੱਲ ਪਈਆਂ ਨੇ ਬੀਜ ਵਾਸਤੇ ਜਿਵੇਂ ਆਪਾਂ ਸਰੋਤ ਜਾਣਕਾਰੀ ਜਾਣਕਾਰੀ ਅਸੀਂ ਬੀਜਾਂ ਦੀ ਫ਼ਸਲਾਂ ਦੀ ਲੈਣੀ ਹੁੰਦੀ ਹੈ ਅਤੇ ਉਹ ਅਸੀਂ ਜਾਂ ਤਾਂ ਅਖ਼ਬਾਰਾਂ 'ਤੇ ਜਾਂ ਅਸੀਂ ਟੀ ਵੀ ਵਿੱਚ ਦੇਖਦੇ ਹਾਂ ਅਤੇ ਜਾਂ ਖੇਤੀ ਦੇ ਮੇਲੇ ਲਗਾਏ ਜਾਂਦੇ ਹਨ ਉੱਥੇ ਜਾ ਕੇ ਅਸੀਂ ਖੇਤ ਦਾ ਜੋ ਵੀ ਕੰਮ ਹੈ ਉੱਥੋਂ ਜਾਣਕਾਰੀ ਲੈਂਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਕੀ ਕਰਨਾ ਹੈ ਉਹਦੀ ਜਾਣਕਾਰੀ ਅਸੀਂ ਮੇਲਿਆਂ ਤੋਂ ਲੈਂਦੇ ਹਾਂ ਖੇਤੀ ਮੇਲੇ ਲਗਾਏ ਜਾਂਦੇ ਹਨ